ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਅਤੇ ਵੀਰਾਂ ਨੂੰ ਮੈਂ ਮਾਨਵ ਪਠਾਣੀਆ ਪੰਜਾਬ ਦਾ ਰਹਿਣ ਵਾਲਾ ਹਾਂ ਜਿੱਦਾਂ ਕਿ ਇਹਨਾਂ ਦਾ ਪ੍ਰਸ਼ਨ ਹੈ ਕਿ ਕੀ ਤੁਸੀਂ ਕਦੇ ਕਿਸੇ ਖੇਡਾਂ ਦੀ ਕਹਾਣੀ ਜਾਂ ਪਾਤਰਾਂ ਵਿੱਚ ਸੱਚਮੁੱਚ ਨਿਵੇਸ਼ ਕੀਤਾ ਹੈ ਕਿਹੜੀ ਖੇਡ ਅਤੇ ਕਿਉਂ ਅਗਰ ਮੈਂ ਇਸ ਦਾ ਸੱਚਮੁੱਚ ਦਾ ਜਵਾਬ ਦੇਵਾਂ ਤਾਂ ਇਸ ਦਾ ਮੇਰਾ ਜਵਾਬ ਇਹ ਹੋਏਗਾ ਕਿ ਮੈਂ ਕਿਸੇ ਵੀ ਖੇਡ ਦਾ ਦੀ ਕਹਾਣੀ ਜਾਂ ਪਾਤਰਾਂ ਨਿਵੇਸ਼ ਨਹੀਂ ਕੀਤਾ ਹੈ ਧੰਨਵਾਦ